ਬਲੈਕ ਹੋਲ ਬਰਮਹੋਲ ਭੌਤਿਕ ਵਿਗਿਆਨ ਅਤੇ ਵਿਗਿਆਨਕ ਗਲਪਾਂ ਵਿੱਚ ਵੀ ਦੋ ਚਸ ਦੋ ਦਿਲਚਸਪ ਵਿਸ਼ੇ ਹਨ ਬਲੈਕ ਹੋਲ ਇੱਕ ਬਹੁਤ ਸੰਘਣੀ ਵਸਤੂ ਹੈ ਜਿਸ ਵਿੱਚ ਵੱਡੀ ਮਾਤਰਾ ਵਿੱਚ ਪਦਾਰਥ ਅਤੇ ਊਰਜਾ ਹੁੰਦੀ ਹੈ ਇਸ ਲਈ ਇਹ ਬਹੁਤ ਮਜ਼ਬੂਤ ਗਰੈਵੀਟੇਸ਼ਨ ਫੀਲਡ ਬਣਾਉਂਦੇ ਹਨ ਜੋ ਇਸ ਦੇ ਆਲੇ ਦੁਆਲੇ ਦੇ ਸਪੇਸਟਾਇਮ ਨੂੰ ਵਿਗਾੜਦੇ ਹਨ ਬਲੈਕ ਹੋਲ ਦਾ ਸੰਕਲਪ ਜਨਰਲ ਰਿਲੇਟੀਵਿਟੀ ਦੇ ਸਿਧਾਂਤ ਵਿੱਚ ਸੁਝਾਅ ਦਿੱਤਾ ਗਿਆ ਹੈ ਅਤੇ ਇਹ ਦਹਾਕਿਆਂ ਤੋਂ ਇੱਕ ਸਿਧਾਂਤਕ ਸੰਕਲਪ ਸੀ ਅੰਤ ਵਿੱਚ ਭੌਤਿਕ ਵਿਗਿਆਨੀ ਚੌਦਾਂ ਸਤੰਬਰ ਦੋ ਹਜ਼ਾਰ ਪੰਦਰਾਂ ਨੂੰ ਪਹਿਲੀ ਵਾਰ ਗਰੈਵੀਟੇਸ਼ਨ ਤਰੰਗਾਂ ਦਾ ਪਤਾ ਲਗਾਉਣ ਤੋਂ ਬਾਅਦ ਬਲੈਕ ਹੋਲ ਦੀ ਹੋਂਦ ਦੀ ਪੁਸ਼ਟੀ ਕਰਨ ਵਿੱਚ ਲਈ ਖੁਸ਼ ਕਿਸਮਤ ਹਨ ਬਰਮਹੋਲ ਇੱਕ ਸਿਧਾਂਤਕ ਸੰਕਲਪ ਹੈ ਜੋ ਆਇਨਸਟੈਂਨ ਅਤੇ ਰੁਸੇਨ ਦੁਆਰਾ ਸੁਝਾਅ ਦਿੱਤਾ ਗਿਆ ਹੈ ਇੱਕ ਬਰਮਹੋਲ ਪੁਲਾੜ ਸਮੇਂ ਜਾਂ ਦੋ ਵੱਖ ਵੱਖ ਬ੍ਰਹਿਮੰਡਾਂ ਵਿੱਚ ਦੋ ਬਿੰਦੂਆਂ ਨੂੰ ਜੋੜਦਾ ਹੈ ਕਿਸੀ ਵੀ ਤਰ੍ਹਾਂ ਅੱਜ ਤੱਕ ਸਿਰਫ ਸਿਧਾਂਤਿਕ ਭੌਤਿਕ ਵਿਗਿਆਨ ਵਿੱਚ ਮੌਜੂਦ ਹਨ ਇਹ ਬਲੈਕ ਹੋਲ ਅਤੇ ਬਰਮਹੋਲ ਵਿਚਕਾਰ ਮੁੱਖ ਅੰਤਰ ਹੈ ਬਲੈਕ ਹੋਲ ਤਾਰੇ ਬ੍ਰਹਿਮੰਡ ਵਿੱਚ ਵਿਸ਼ਾਲ ਕੁਦਰਤੀ ਥਰਮੋਨਿਊਕਲੀਅਰ ਪਾਵਰ ਪਲਾਂਟ ਹਨ ਬਲੈਕ ਹੋਲ ਚਿੱਟੇ ਬੌਣੇ ਅਤੇ ਨਿਊਟ੍ਰਨ ਤਾਰੇ ਕਿਸੇ ਡਿਗਣ ਤਾਰੇ ਦੇ ਕੁਛ ਸੁਭਾਵਤਨ ਨਤੀਜੇ ਹਨ ਇਸ ਲਈ ਬਲੈਕ ਹੋਲ ਦੇ ਗਠਨ ਨੂੰ ਸਮਝਣ ਲਈ ਤੈਰਾਂ ਦੀ ਉਤਪੱਤੀ ਦੀ ਸਪਸ਼ਟ ਸਮਝ ਹੋਣੀ ਚਾਹੀਦੀ ਹੈ ਬਿਗ ਬੈਂਗ ਤੋਂ ਬਾਅਦ ਇਹ ਮਾਮਲਾ ਲਗਭਗ ਪ੍ਰੋਟੋਨ ਇਲੈਕਟਰੋਨ ਅਤੇ ਕੁਝ ਹੋਰ ਪ੍ਰਕਾਸ਼ ਨਿਊਕਲੀਅਰ ਦੇ ਰੂਪ ਵਿੱਚ ਸੀ ਇਹ ਸਾਰੇ ਬ੍ਰਹਿਮੰਡ ਵਿੱਚ ਗੈਸ ਵਾਂਗ ਤੈਰ ਰਹੇ ਹਨ ਜਿਵੇਂ ਜਿਵੇਂ ਬ੍ਰਹਿਮੰਡ ਠੰਡਾ ਹੁੰਦਾ ਗੁਰੂਤਾਕਰਸ਼ਣ ਸ਼ਕਤੀਆਂ ਇਹਨਾਂ ਵਿੱਚ ਕੁਝ ਕਣਾਂ ਨੂੰ ਇਕੱਠੇ ਲਿਆ ਸਕਦੀਆਂ ਹਨ ਅਤੇ ਵਿਸ਼ਾਲ ਗੈਸੀ ਬੱਦਲ ਬਣ ਗਏ ਸਨ ਜਿਵੇਂ ਜਿਵੇਂ ਗ੍ਰੈਵੀਟੇਸ਼ਨ ਬਲਾਂ ਨੇ ਬੱਦਲਾਂ ਵਿਚਾਲੇ ਪਦਾਰਥ ਨੂੰ ਇਕੱਠੇ ਆਕਰਸ਼ਿਤ ਕੀਤਾ ਕਣ ਹੋਰ ਨੇੜੇ ਆ ਗਏ ਇਸ ਲਈ ਕਣਾਂ ਦੀ ਗਿਣ ਦੀ ਗਤੀਸ਼ੀਲ ਊਰਜਾ ਵਿੱਚ ਵਾਧਾ ਹੋਇਆ ਬੱਦਲਾਂ ਦੇ ਸੁੰਗੜਨ ਨਾਲ ਤਾਪਮਾਨ ਲਗਾਤਾਰ ਵੱਧਦਾ ਗਿਆ ਅੰਤ ਵਿੱਚ ਅੰਦਰੂਨੀ ਤਾਪਮਾਨ ਲਗਭਗ ਸੱਤ ਹਜ਼ਾਰ ਤੱਕ ਪਹੁੰਚ ਗਿਆ ਅਜਿਹੇ ਬੱਦਲ ਦੀ ਘਣਤਾ ਬਹੁਤ ਜ਼ਿਆਦਾ ਸੀ ਇਸ ਲਈ ਡਿੱਗ ਰਹੇ ਬੱਦਲ ਪਰਮਾਣੂ ਫਿਊਜ਼ਨ ਪ੍ਰਤੀਕਰਮਾਂ ਲਈ ਜ਼ਰੂਰੀ ਸਥਿਤੀ ਤੱਕ ਪਹੁੰਚ ਗਏ ਅਤੇ ਤਾਰੇ ਪੈਦਾ ਹੋਏ ਪਰ ਤਾਰੇ ਦੇ ਫਿਊਜ਼ਨ ਬਾਲਣ ਦੀ ਵਰਤੋਂ ਕਰਨ ਤੋਂ ਬਾਅਦ ਤਾਰੇ ਦੇ ਪੁੰਜ ਤਾਰੇ ਦੀਆਂ ਗ੍ਰੈਵੀਟੇਸ਼ਨ ਬਲਾਂ ਦੁਆਰਾ ਬਹੁਤ ਘੱਟ ਮਾਤਰਾ ਵਿੱਚ ਸੰਕੁਚਿਤ ਹੁੰਦਾ ਹੈ ਕਿਉਂਕੀ ਬਾਕੀ ਗਰਮੀ ਅਤੇ ਰੇਡੀਏਸ਼ਨਾਂ ਦਾ ਦਬਾਅ ਇਸ ਦੀਆਂ ਆਪਣੀਆਂ ਗ੍ਰੈਵੀਟੇਸ਼ਨਾਂ ਤਾਕਤਾਂ ਨੂੁੰ ਸੰਤੁਲਿਤ ਕਰਨ ਲਈ ਕਾਫੀ ਨਹੀਂ ਹੁੰਦਾ ਨਤੀਜਾ ਬਹੁਤ ਸੰਘਣੀ ਗਦ ਹੈ ਇਹ ਤਾਰਾ ਆਪਣੇ ਪੁੰਜ ਅਤੇ ਜਾਂ ਇੱਕ ਚਿੱਟਾ ਬੌਣਾ ਨਿਊਟ੍ਰਨ ਤਾਰਾ ਜਾਂ ਬਲੈਕ ਹੋਲ ਬਣ ਜਾਂਦਾ ਹੈ ਇੱਕ ਪੁਆਇੰਟ ਚਾਰ ਸੂਰਜੀ ਪੁੰਜ ਤੋਂ ਘੱਟ ਪੁੰਜ ਵਾਲਾ ਤਾਰਾ ਚਿੱਟਾ ਬੌਣਾ ਤਾਰਾ ਬਣ ਜਾਂਦਾ ਹੈ ਲਗਭਗ ਤਿੰਨ ਤੋਂ ਵੱਧ ਸੂਰਜੀ ਪੁੰਜ ਵਾਲੇ ਤਾਰੇ ਇੱਕ ਹੋਰ ਖੋਲ ਪੜਾਅ ਰਾਹੀਂ ਬਲੈਕ ਹੋਲ ਬਣਾਉਂਦੇ ਹਨ ਅਤੇ ਇਹਨਾਂ ਹੀ ਕੁਝ ਚੀਜ਼ਾਂ ਤੋਂ ਮਿਲ ਕੇ ਗਲੈਕਸੀ ਬਣਦੀ ਹੈ